ਜੀ ਹਾਂ ਡਰੋਨ ਨਾਲ ਸ਼ੂਟਿੰਗ ਕਰਨ ਦਾ ਮੌਕਾ ਮੈਨੂੰ ਮਿਲਿਆ ਹੈ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਦੋਂ ਮੈਨੂੰ ਅਤੇ ਕਿਸੇ ਪੁਲਿਸ ਵਿਭਾਗ ਵੱਲੋਂ ਹਾਇਰ ਕੀਤਾ ਗਿਆ ਸੀ ਉਦੋਂ ਮੈਂ ਡਰੋਨ ਦੇ ਨਾਲ਼ ਏਰੀਏ ਨੂੰ ਸੁਰੱਖਿਅਤ ਸਰੱਖਿਅਤ ਦੇਖਿਆ ਅਤੇ ਲੋਕਾਂ ਨੂੰ ਬਾਹਰ ਨਿਕਲਣ ਤੋਂ ਸੂਚਿਤ ਕੀਤਾ ਅਤੇ ਜਿਹੜਾ ਨਿਕਲ਼ਦਾ ਸੀ ਉਸਦੇ ਖਿਲਾਫ਼ ਕਾਰਵਾਈ ਕਰਨ ਦਾ ਮੌਕਾ ਮਿਲਦਾ ਸੀ